ਹਾਂ ਇਹ ਸੱਚ ਹੈ ਕਿ ਹਰੇਕ ਸੰਸਥਾ ਵਿੱਚ ਜੋ ਕਿ ਪੇਂਡੂ ਔਰਤਾਂ ਨੂੰ ਸਿੱਖਿਆ ਅਤੇ ਕੰਮ ਕਰਨ ਵਿੱਚ ਸਮਾਜ ਉਨ੍ਹਾਂ ਦੀ ਭਲਾਈ ਕਰਦਾ ਹੈ ਹਰੇਕ ਖੇਤਰ ਵਿੱਚ ਕੋਈ ਨਾ ਕੋਈ ਭਲਾਈ ਕੇਂਦਰ ਹੁੰਦਾ ਹੈ ਜਿੱਥੇ ਕਿ ਪੇਂਡੂ ਔਰਤਾਂ ਦੀਆਂ ਦੀ ਸੇਵਾ ਜਾਂ ਉਨ੍ਹਾਂ ਦੀ ਹਰੇਕ ਗੱਲ ਸੁਣੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਭਲਾਈ ਕੇਂਦਰ ਵਿੱਚ ਫ੍ਰੀ ਰਾਸ਼ਨ ਦਿੱਤਾ ਜਾਂਦਾ ਹੈ ਜਿਵੇਂ ਕਿ ਆਟਾ ਦਾਲ ਆਦਿ ਦਿੰਦੇ ਹਨ ਪੇਂਡੂ ਖੇਤਰਾਂ ਵਿੱਚ ਇੱਕ ਇਹੋ ਜਿਹਾ ਸਮਾਜ ਬਣਾਇਆ ਹੋਇਆ ਹੈ ਕੇ ਗਰੀਬ ਲੋਕਾਂ ਦੀ ਸੇਵਾ ਕਰਦਾ ਹੈ ਪੇਂਡੂ ਔਰਤਾਂ ਲਈ ਸਰਕਾਰ ਦੁਆਰਾ ਬਹੁਤ ਸਾਰੇ ਨਿਗਮ ਨਿਯਮ ਬ ਲਾਗੂ ਕੀਤੇ ਗਏ ਹਨ ਪੇਂਡੂ ਔਰਤਾਂ ਦੀਆਂ ਬੇਟੀਆਂ ਬੇਟੀਆਂ ਲਈ ਸਮਾਜ ਦੁਆਰਾ ਉਨ੍ਹਾਂ ਦੇ ਵਿਵਾ ਵਿ ਵਿਆਹ ਕਰੇ ਜਾਂਦੇ ਹਨ ਜਦੋਂ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਸਮਾਜ ਉਨ੍ਹਾਂ ਦੀ ਸੇਵਾ ਕਰਦਾ ਹੈ ਸਮਾਜ ਦਾ ਬਹੁਤ ਵਰਗ ਬੇਸ਼ੱਕ ਪੜ੍ਹ ਲਿਖ ਗਿਆ ਹੈ ਪਰ ਉਨ੍ਹਾਂ ਉਸ ਦੀ ਸੋਚ ਹੀ ਵਿੱਚ ਬਹੁਤ ਹੀ ਫ਼ਰਕ ਦੇਖਣ 'ਚ ਨਹੀਂ ਆਇਆ ਔਰਤਾਂ ਜੱਦੋ ਜਹਿਦ ਕਰਦੀਆਂ ਹੋਈ ਮਰਦ ਦੇ ਬਰਾਬਰ ਹੀ ਨਹੀਂ ਬਲਕਿ ਓ ਉਸ ਤੋਂ ਅਗੇਰੇ ਉਡਾਰੀਆਂ ਲਾ ਰਹੀ ਹੈ ਪਰ ਫਿਰ ਵੀ ਬਹੁਤ ਸਾਰੀਆਂ ਰੁਕਾਵਟਾਂ ਨਾ ਸਿਰਫ਼ ਸਿੱਖਿਆ ਹਾਸਲ ਕਰਨ ਸਮੇਂ ਸਗੋਂ ਪੜ੍ਹਾਈ ਤੋਂ ਬਾਅਦ ਉਸ ਦਾ ਪਿੱਛਾ ਨਹੀਂ ਛੱਡਦੀਆਂ ਔਰਤਾਂ ਮੁੱਢ ਤੋਂ ਹੀ ਸਿਵਾ ਸਵੰਸੀਵਿਕ ਕੇਂਦਰ ਅਤੇ ਸਹਿਣਸ਼ੀਲਤਾ ਦੀ ਮੂਰਤ ਰਹੀ ਹੈ ਪਰ ਮਰਦ ਪ੍ਰਧਾਨ ਸਮਾਜ ਵਿੱਚ ਉਸਦੀ ਸਹਿਣਸ਼ੀਲਤਾ ਦਾ ਕਿਤੇ ਨਜਾਇਜ਼ ਫ਼ਾਇਦਾ ਉਠਾਇਆ ਜਾਂਦਾ ਹੈ ਉਨ੍ਹਾਂ ਨੂੰ ਸਕੂਲ ਲਗਾਉਣ ਤੋਂ ਪਹਿਲਾਂ ਵੀ ਹਲਾਤਾਂ ਬਾਰੇ ਸੋਚਣਾ ਪੈਂਦਾ ਹੈ ਸਾਡੇ ਪਿੰਡ ਵਿੱਚ ਇੱਕ ਸਮਾਜ ਪਗਟੀ ਬਣੀ ਹੋਈ ਹੈ ਜਿਸ ਵਿ ਜਿਸ ਵਿੱਚ ਮੈਂਬਰ ਬਣਦੀਆਂ ਹੋਈਆਂ ਜੋ ਕਿ ਆਦਮੀ ਵਿਹਲੇ ਫਿਰਦੇ ਹਨ ਉਨ੍ਹਾਂ ਉਹ ਨੂੰ ਰੁਜ਼ਗਾਰ ਦਵਾਉਣ ਵਿੱਚ ਬਹੁਤ ਹੀ ਸਹਾਇਤਾ ਕੀਤੀ ਜਾਂਦੀ ਹੈ